ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਲੋਕ ਵਿ ਵਿਆਹ ਵਿੱਚ ਲਾੜੀ ਨੂੰ ਕੀ ਤੋਹਫੇ ਦਿੰਦੇ ਹਨ ਅਤੇ ਦਾਜ ਬਾਰੇ ਗੱਲਬਾਤ ਕਰਨ ਲੱਗੀ ਹਾਂ ਲੋਕ ਵਿਆਹ 'ਤੇ ਲਾੜੀ ਨੂੰ ਕੀ ਤੋਹਫੇ ਦਿੰਦੇ ਹਨ ਲੋਕ ਵਿਵਾਹ ਦੀਆਂ ਤਿਆਰੀਆਂ ਕਾਫੀ ਟਾਈਮ ਪਹਿਲਾਂ ਤੋਂ ਸ਼ੁਰੂ ਕੀਤੀਆਂ ਜਾਂਦੀਆਂ ਹਨ ਜਿਸ ਵਿੱਚ ਮਾਂ ਪਿਓ ਕਾਫੀ ਤਿਆਰੀਆਂ ਕਰਦੇ ਹਨ ਘਰ ਦੀ ਸਾਫ ਸਫਾਈ ਬਾਹਰੋਂ ਵਿਆਹ ਦੇ ਸਮੇਂ ਲਾੜੀ ਦੇ ਲਾੜੀ ਵਸਤੇ ਕੱਪੜੇ ਲੀੜੇ ਲਿਆਉਣੇ ਹੋਰ ਹਾਰ ਸ਼ਿੰਗਾਰ ਦਾ ਸਮਾਨ ਲਿਆਉਣਾ ਗਹਿਣੇ ਗੱਟੇ ਲਿਆਉਣੇ ਫਿਰ ਹੋਰ ਵੀ ਕਾਫੀ ਜ਼ਿਆਦਾ ਲੋਕਾਂ ਨੂੰ ਜਿਹੜੀ ਰੋਟੀ ਰੁਟੀ ਖਵਾਉਣੀ ਹੁੰਦੀ ਉਹਦੀਆਂ ਤਿਆਰੀਆਂ ਕਰਦੇ ਆ ਉਹਦੀਆਂ ਤਿਆਰੀਆਂ ਕਰਨ ਤੋਂ ਬਾਅਦ ਫਿਰ ਵਿਆਹ ਦੇ ਗੀਤ ਰੱਖੇ ਜਾਂਦੇ ਆ ਗੀਤ ਰੱਖ ਕੇ ਲਾੜੀ ਨੂੰ ਦਈ ਦਹੀਂ ਵਗੈਰਾ ਚੜ੍ਹਾਇਆ ਜਾਂਦਾ ਤੇਲ ਚੜਾਇਆ ਜਾਂਦਾ ਬਟਨਾ ਲਗਾਇਆ ਜਾਂਦਾ ਫਿਰ ਉਹਨੂੰ ਜਦੋਂ ਵਿਆਹ ਵਾਲਾ ਦਿਨ ਆਉਂਦਾ ਫਿਰ ਉਹਨੂੰ ਤਿਆਰ ਕੀਤਾ ਜਾਂਦਾ ਹੈ ਫਿਰ ਤਿਆਰ ਕਰਨ ਤੋਂ ਬਾਅਦ ਉਹਨੂੰ ਅਸੀਂ ਡੋਲੀ ਉਹਦੇ ਮੁੰਡੇ ਵਾਲੇ ਆਉਂਦੇ ਆ ਸ਼ਗਨ ਸੁਗਣ ਪਾਉਂਦੇ ਆ ਫਿਰ ਜਿਹੜੀ ਲਾੜੀ ਦੀਆਂ ਸਹੇਲੀਆਂ ਹੁੰਦੀਆਂ ਰਿਸ਼ਤੇਦਾਰ ਹੁੰਦੇ ਆ ਉਹ ਉਹਨਾਂ ਨੂੰ ਤੋਹਫੇ ਦਿੰਦੇ ਹਨ ਫਿਰ ਕਾਫੀ ਜ਼ਿਆਦਾ ਕੱਪੜੇ ਗਿਫਟ ਸੋਨੇ ਚਾਂਦੀ ਦੇ ਸਮਾਨ ਜਿੱਦਾਂ ਉਹ ਦੇ ਸਕਦੇ ਹੋ ਤੁਸੀਂ ਹੋਰ ਤੁਸੀਂ ਕੋਈ ਵੀ ਗਿਫਟ ਹੈ ਜਿੱਦਾਂ ਕੱਪ ਪਲੇਟਾਂ ਗਲਾਸ ਭਾਂਡੇ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਤੁਸੀਂ ਉਹਨਾਂ ਨੂੰ ਦੇ ਸਕਦੇ ਹੋ ਅਤੇ ਇਸ ਦੇ ਵਿੱਚ ਲਾੜੀ ਨੂੰ ਦਾਜ ਵੀ ਦਿੱਤਾ ਜਾਂਦਾ ਹੈ ਜੋ ਕਿ ਉਹਦੇ ਘਰ ਦੇ ਕਾਫੀ ਸਮੇਂ ਤੋਂ ਤਿਆਰ ਕਰ ਰਹੇ ਹੁੰਦੇ ਹਨ ਬਿਸਤਰਾ ਫਿਰ ਮੰਜੇ ਬਿਸਤਰੇ ਫਿਰ ਹੋਰ ਗਹਿਣੇ ਦਾ ਸਮਾਨ ਕੋਈ ਗੱਡੀ ਮੋਟਰਸਾਈਕਲ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਦੇ ਸਕਦੇ ਹਾਂ ਆਪਾਂ ਉਹਨਾਂ ਨੂੰ ਠੀਕ ਆ ਅਤੇ ਫਿਰ ਬਾਅਦ 'ਚੋਂ ਲਾੜੀ ਨੂੰ ਜਿਹੜੀ ਆਪਣੇ ਗਿਫਟ ਗੁਫਟ ਹੁੰਦੇ ਆ ਉਹ ਆਪਣੇ ਨਾਲ ਲੈ ਜਾਂਦੀ ਹੈ ਆਪਣੇ ਘਰ ਅਤੇ ਇਸ ਤਰ੍ਹਾਂ ਲਾੜੀ ਨੂੰ ਵਿਆਹ 'ਤੇ ਗਿਫਟ ਮਿਲਦੇ ਆ ਇਹਨੂੰ ਤੋਹਫੇ ਮਿਲਦੇ ਆ ਅਤੇ ਦਾਜ ਵੀ ਦੇਣਾ ਜ਼ਰੂਰੀ ਹੁੰਦਾ ਹੈ ਜੋ ਕਿ ਅੱਜ ਦੇ ਸਮੇਂ ਵਿੱਚ ਇਹ ਰੀਤ ਜਿਹੜੀ ਹੈ ਘੱਟ ਰਹੀ ਹੈ ਧੰਨਵਾਦ ਜੀ